ਮੈਂ ਕਲੱਬ ਜਾਂ ਕਿਸੇ ਸਮੂਹ ਦੇ ਵਿੱਚ ਨਹੀਂ ਦੌੜਿਆ ਕਿਉਂਕਿ ਮੈਨੂੰ ਟਾਈਮ ਨਹੀਂ ਮਿਲਦਾ ਅਤੇ ਮੈਂ ਆਪਣੇ ਘਰ ਦੇ ਹੀ ਕੰਮ ਮੈਨੂੰ ਬਹੁਤ ਨੇ ਜਿਹੜੇ ਕਿ ਸਵੇਰੇ ਮੈਨੂੰ ਮੈਂ ਕਰਦਾ ਏ ਜਿਵੇਂ ਕਿ ਡੰਗਰਾਂ ਨੂੰ ਸਹੀ ਟਾਈਮ ਦੇ ਕੱਖ ਪਾਉਣੇ ਅਤੇ ਉਹਨਾਂ ਦਾ ਗੋਹਾ ਚੱਕਣਾ ਅਤੇ ਗੋਹਾ ਚੁੱਕਣ ਤੋਂ ਬਾਅਦ ਅਤੇ ਹੋਰ ਧਾਰਾਂ ਵੀ ਕੱਢਣੀਆਂ ਅਤੇ ਫਿਰ ਮੈਨੂੰ ਮੈਨੂੰ ਪੰਜ ਕਿਲੋਮੀਟਰ ਸਾਈਕਲ ਚਲਾ ਕੇ ਮੈਂ ਆਪਣੀ ਡਿਊਟੀ 'ਤੇ ਜਾਂਦਾ ਏ ਕੋਲਜ ਵਿੱਚ ਫਿਰ ਮੈਨੂੰ ਕੋਲਜ ਦੇ ਵਿੱਚ ਵੀ ਕੰਮ ਕਰਨੇ ਪੈਂਦੇ ਨੇ ਅਤੇ ਕੋਲਜ ਤੋਂ ਜਦੋਂ ਮੈਨੂੰ ਛੁੱਟੀ ਹੁੰਦੀ ਹੈ ਤਾਂ ਮੈਨੂੰ ਸਾਢੇ ਚਾਰ ਵਜੇ ਛੁੱਟੀ ਹੁੰਦੀ ਹੈ ਇਸ ਕਰਕੇ ਮੈਂ ਜਦੋਂ ਫਿਰ ਆਪਣੇ ਪਿੰਡ ਵੱਲ ਜਾਂਦਾ ਤਾਂ ਫਿਰ ਪੰਜ ਕਿਲੋਮੀਟਰ ਸਾਈਕਲ ਚਲਾਉਣਾ ਅਤੇ ਉਹ ਦਸ ਕਿਲੋਮੀਟਰ ਹੋ ਜਾਂਦਾ ਏ ਤਾਂ ਕਿ ਫਿਰ ਜਾ ਕੇ ਮੈਂ ਪੱਠੇ ਲੈ ਕੇ ਆਉਂਦਾ ਏ ਅਤੇ ਡੰਗਰਾਂ ਦੀ ਦੇਖਭਾਲ ਕਰਦਾ ਏ ਜਿਵੇਂ ਸਵੇਰੇ ਕਰਦਾ ਉਕਣੀ ਜਾ ਕੇ ਫਿਰ ਸ਼ਾਮ ਨੂੰ ਮੈਨੂੰ ਕਰਨੀ ਪੈਂਦੀ ਆ ਜਿਵੇਂ ਕਿ ਉਹਨਾਂ ਨੂੰ ਟੋਕਾ ਕਰਨਾ ਅਤੇ ਟੋਕਾ ਕਰਕੇ ਉਹਨਾਂ ਨੂੰ ਕੱਖ ਪਾਉਣੇ ਧਾਰਾਂ ਕੱਢਣੀਆਂ ਫਿਰ ਉਹਨਾਂ ਸ਼ਾਮ ਦਾ ਗੋਹਾ ਚੱਕਣਾ ਅਤੇ ਜਿਵੇਂ ਮੈਨੂੰ ਕਲੱਬ ਦੇ ਵਿੱਚ ਮੈਨੂੰ ਘਰ ਦੇ ਕੰਮਾਂ 'ਚੋਂ ਹੀ ਵੇਹਲ ਨਹੀਂ ਮਿਲਦੇ ਇਸ ਕਰਕੇ ਮੈਂ ਕਲੱਬ ਅਤੇ ਸਮੂਹ ਦੇ ਵਿੱਚ ਨਹੀਂ ਕਦੇ ਭੱਜਿਆ